ਪੰਜਾਬ ਵਿੱਚ ਬਹੁਤ ਹੀ ਪ੍ਰਮੁੱਖ ਆਰਟ ਗੈਲਰੀਆਂ ਹਨ ਜਿਵੇਂ ਗਵਅਮੈਂਟ ਕਾਲਜ ਆਫ ਆਰਟਸ ਚੰਡੀਗੜ੍ਹ ਇਹ ਚੰਡੀਗੜ੍ਹ ਦੀ ਸਭ ਤੋਂ ਵੱਡੀ ਆਟ ਗੈਲਰੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਵੱਡੀਆਂ ਵੱਡੀਆਂ ਆਰਟ ਗੈਲਰੀਆਂ ਵੱਖਰੀ ਵੱਖਰੀਆਂ ਸਟੇਟ ਦੇ ਵਿੱਚ ਮੌਜੂਦ ਹਨ ਪਰ ਸਾਡੇ ਪੰਜਾਬ ਵਿੱਚ ਕੁਝ ਗਿਣੀਆਂ ਚੁਣੀਆਂ ਆਰਟ ਗੈਲਰੀਆਂ ਹਨ ਜੋ ਕਿ ਪ੍ਰਸਿੱਧ ਹਨ ਮੇਰੇ ਇਲਾਕੇ ਵਿੱਚ ਤਾਂ ਕੋਈ ਆਰਟ ਗੈਲਰੀ ਨਹੀਂ ਹੈ ਪਰ ਮੇਰੇ ਇਲਾਕੇ ਦੇ ਆਸ ਪਾਸ ਇਹੋ ਜਿਹੀਆਂ ਬਹੁਤ ਆਰਟ ਗੈਲਰੀਆਂ ਹਨ ਜੋ ਕਿ ਪ੍ਰਸਿੱਧ ਹਨ ਅਤੇ ਇਹ ਇਹਨਾਂ ਚੀਜ਼ਾਂ ਨੂੰ ਦੇ ਦਿਖਾਉਂਦੀਆਂ ਹਨ ਜੋ ਕਿ ਕਲਾਕਾਰ ਇਹਨਾਂ ਚੀਜ਼ਾਂ ਨੂੰ ਬਣਾਉਂਦੇ ਹਨ ਜੋ ਆਰਟ ਗੈਲਰੀ ਵਿੱਚ ਦਿਖਾਈਆਂ ਜਾਂਦੀਆਂ ਹਨ ਗਵਾਮੈਂਟ ਕੋਲਜ ਔਫ ਆਰਟਸ ਚੰਡੀਗੜ੍ਹ ਆਰਟ ਗੈਲਰੀ ਬਹੁਤ ਪ੍ਰਸਿੱਧ ਅਤੇ ਵੱਡੀ ਹੈ